ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਸਾਨੂੰ ਹਰ ਖੁਸ਼ੀ ਮੌਕੇ ਭੰਗੜਾ ਜ਼ਰੂਰ ਪਾਉਣਾ ਚਾਹੀਦਾ ਹੈ ਪੰਜਾਬ ਅਤੇ ਪੰਜਾਬ ਤੋਂ ਬਾਹਰ ਕਿਤੇ ਵੀ ਪੰਜਾਬੀ ਵੱਸਦੇ ਹਨ ਅਤੇ ਉਹ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਭੰਗੜਾ ਨਾ ਪਾਇਆ ਜਾਵੇ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ 'ਤੇ ਤੁਸੀਂ ਵਿਸਾਖੀ ਦੇ ਤਿਉਹਾਰ 'ਤੇ ਵੀ ਪਾਇਆ ਜਾਂਦਾ ਹੈ ਭੰਗੜਾ ਸਾਡੇ ਬਹੁਤ ਪ੍ਰਚਲਿਤ ਹੈ ਭੰਗੜਾ ਹਰ ਇੱਕ ਖੁਸ਼ੀ ਨੂੰ ਵਧਾ ਦਿੰਦਾ ਹੈ ਚਾਹੇ ਬੱਚਿਆਂ ਦੀ ਲੋਹੜੀ ਮਨਾਉਣੀ ਹੋਵੇ ਤਾਂ ਵੀ ਭੰਗੜਾ ਪਾਇਆ ਜਾਂਦਾ ਹੈ ਵਿਆਹ ਸ਼ਾਦੀ ਵਿੱਚ ਵੀ ਭੰਗੜਾ ਪਾਇਆ ਜਾਂਦਾ ਹੈ ਜਦੋਂ ਅਸੀਂ ਕੋਈ ਵੀ ਖੁਸ਼ੀ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਭੰਗੜਾ ਪਾ ਕੇ ਹੀ ਖੁਸ਼ੀ ਦਾ ਕੰਮ ਬਹੁਤ ਵਧੀਆ ਲੱਗਦਾ ਹੈ ਇਸ ਨਾਲ ਇਸਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਸ਼ੁਰੂਆਤ ਪੰਜਾਬੀ ਭੰਗੜੇ ਤੋਂ ਹੀ ਕੀਤੀ ਜਾਂਦੀ ਹੈ ਕੋਈ ਵੀ ਕੰਮ ਕਰਨਾ ਹੋਵੇ ਖੁਸ਼ੀ ਦਾ ਕੋਈ ਵੀ ਕੰਮ ਹੋਵੇ ਕੋਈ ਵਿਸਾਖੀ ਕੋਈ ਲੋਹੜੀ ਬੱਚੇ ਦੀ ਸਭ ਸਾਨੂੰ ਇਹਦੇ ਨਾਲ ਹੀ ਭੰਗੜੇ ਨਾਲ ਹੀ ਮਨਾਉਣੀ ਚਾਹੀਦੀ ਹੈ ਅਤੇ ਮਨਾਉਣੀ ਵੀ ਚਾਹੀਦੀ ਹੈ ਕਿਉਂਕਿ ਇਹ ਹਰ ਇੱਕ ਖੁਸ਼ੀ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਇਸ ਲਈ ਸਾਨੂੰ ਭੰਗੜਾ ਬਹੁਤ ਖੁਸ਼ੀ ਨਾਲ ਪਾਉਣਾ ਚਾਹੀਦਾ ਹੈ ਇਕੱਲਾ ਹੁਣ ਪੰਜਾਬ ਵਿੱਚ ਨਹੀਂ ਇਹ ਤਾਂ ਬਾਹਰਲੇ ਦੇਸਾਂ ਵਿੱਚ ਵੀ ਭੰਗੜਾ ਸਾਡਾ ਮਸ਼ਹੂਰ ਹੋ ਚੁੱਕਿਆ ਹੈ ਅਤੇ ਕਿਉਂਕਿ ਪੰਜਾਬੀਆਂ ਦਾ ਭੰਗੜਾ ਇਕੱਲੇ ਪੰਜਾਬ ਵਿੱਚ ਨਹੀਂ ਇਹ ਤਾਂ ਬਾਹਰਲੇ ਦੇਸਾਂ ਵਿੱਚ ਤੇ ਵੀ ਭੰਗੜਾ ਪਾਉਣਾ ਸਿੱਖ ਗਏ ਹਨ ਕਿਉਂਕਿ ਜਿੱਥੇ ਪੰਜਾਬੀ ਚਲਾ ਜਾਵੇ ਤਾਂ ਉਹ ਗੁੱਝਾ ਨਹੀਂ ਰਹਿੰਦਾ ਇਸ ਲਈ ਉਹ ਭੰਗੜੇ ਤੋਂ ਪ੍ਰਚਲਿਤ ਹੋ ਜਾਂਦਾ ਹੈ ਅਤੇ ਕਿਉਂਕਿ ਉਹ ਭੰਗੜਾ ਪਾਉਣ ਜਾਣਦਾ ਹੈ ਸਾਨੂੰ ਭੰਗੜੇ ਦੀ ਹਰ ਇੱਕ ਖੁਸ਼ੀ 'ਤੇ ਬਹੁਤ ਮਾਣ ਹੈ ਸਾਨੂੰ ਆਪਣੇ ਭੰਗੜੇ ਦਾ ਬਹੁਤ ਮਾਣ ਹੈ